ਪੰਜਾਬ ਵਿੱਚ ਬਹੁਤ ਜ ਸਿੱਖਿਆ ਦੇ ਖੇਤਰ ਹਨ ਜਿਨ੍ਹਾਂ ਵੱਲ ਆਪਾਂ ਧਿਆਨ ਦੇ ਸਕਦੇ ਹਾਂ ਜਿਨ੍ਹਾਂ ਨਾਲ ਵਿਕਾਸ ਵੀ ਹੋ ਰਿਹਾ ਲੋਕਾਂ ਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਸਰਕਾਰ ਨੇ ਗਰੀਬ ਬੱਚਿਆਂ ਦੀ ਸਿਖਲਾਈ ਲਈ ਬਹੁਤ ਸਾਰੇ ਸਰਕਾਰੀ ਵਿੱਦਿਅਕ ਕੇਂਦਰ ਖੋਲ੍ਹੇ ਹਨ ਜਿ ਜਿਵੇਂ ਕਿ ਸਰਕਾਰੀ ਸਕੂਲ ਹੋ ਗਏ ਸਰਕਾਰੀ ਸੰਸਥਾ ਹੈ ਹੋ ਗਈ ਜੋ ਲੋਕਾਂ ਨੂੰ ਪੜ੍ਹਨ ਦੇ ਵਿੱਚ ਜਾਂ ਹੱਥੀਂ ਸਿਖਲਾਈ ਦੇਣ ਦੇ ਵਿੱਚ ਮਦਦ ਕਰਦੇ ਹਨ ਅੰਮ੍ਰਿਤਸਰ ਵਿੱਚ ਵੀ ਇੱਕ ਸਕਿੱਲ ਡਿਵੈਲਪਮੈਂਟ ਨਾਮ ਦਾ ਇੱਕ ਸਿਖਲਾਈ ਕੇਂਦਰ ਹੈ ਜਿੱਥੇ ਵੱਖ ਵੱਖ ਤਰੀਕਿਆਂ ਦੀਆਂ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕੰਪਿਊਟਰ ਕੰਪਿਊਟਰ ਬੇਸਿਕਸ ਹੋ ਗਿਆ ਫੈਸ਼ਨ ਅ ਡਿਜ਼ਾਇਨਿੰਗ ਹੋ ਗਿਆ ਮੈ ਕੋਸ ਮੈਂਟੋਲੋਜੀ ਹੋ ਗਿਆ ਹੋਰ ਵੀ ਕਾਫੀ ਸਾਰੀਆਂ ਸਿਖਲਾਵਾਂ ਦਿੱਤੀਆਂ ਜਾਂਦੀਆਂ ਹਨ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਘੱਟ ਫੀਸ 'ਤੇ ਜਾਂ ਨਾ ਮਾਤਰ ਫੀਸ 'ਤੇ ਬਹੁਤ ਸਾਰਾ ਅਹ ਸਹਿਯੋਗ ਦਿੱਤਾ ਜਾਂਦਾ ਹੈ ਪੜ੍ਹਨ ਲਈ ਉਹਨਾਂ ਨੂੰ ਬ ਅ ਸਕੂਲ ਦੀ ਯੂਨੀਫਾਰਮ ਸ਼ੂਜ ਬੁੱਕਸ ਵਗੈਰ ਬੁੱਕਸ ਵਗੈਰਾ ਵੀ ਅ ਬੁੱਕਸ ਵਗੈਰਾ ਵੀ ਪ੍ਰੈਫਰ ਕੀਤੀਆਂ ਜਾਂਦੀਆਂ ਹਨ ਤਾਂ ਕਿ ਬੱਚੇ ਬੱਚੇ ਮਨ ਲਗਾ ਕੇ ਪੜ੍ਹ ਸਕਣ ਅਤੇ ਦੇਸ਼ ਦੇ ਵਿਕਾਸ ਦੇ ਵਿੱਚ ਮਦਦ ਕਰ ਸਕਣ ਹੋਰ ਵੀ ਅੱਜ ਕੱਲ੍ਹ ਕਈ ਔਨਲਾਈਨ ਸੰਸਥਾਵਾਂ ਖੁੱਲ੍ਹੀਆਂ ਹਨ ਜੋ ਸਾਨੂੰ ਔਨਲਾਈਨ ਸਿੱਖਿਆ ਦੇਣ ਦੇ ਵਿੱਚ ਮਦਦ ਕਰਦੀਆਂ ਹਨ ਜਿਵੇਂ ਕਿ ਹ ਆਪਾਂ ਦੇਖ ਸਕਦੇ ਹਾਂ ਕਰੋਨਾ ਕਾਲ ਦੇ ਵਿੱਚ ਕ ਸਾਰੀਆਂ ਸੰਸਥਾਵਾਂ ਅ ਹੋਣ ਕਰਕੇ ਸਕੂਲ ਅ ਸਰਕਾਰ ਨੇ ਇੱਕ ਔਨਲਾਈਨ ਐਜੂਕੇਸ਼ਨ ਦਾ ਸਿਸਟਮ ਚਲਾਇਆ ਹੈ ਜਿਸ ਨਾਲ ਸਾਰੇ ਦੇ ਸਾਰੇ ਸਕੂਲਾਂ ਵਿੱਚ ਇੱਕ ਐਪ ਔਨਲਾਈਨ ਐਪ ਜ਼ੂਮ ਮੀਟਿੰਗ ਜਾਂ ਗੂਗਲ ਮੀਟ ਦੇ ਨਾਲ ਆਪਾਂ ਔਨਲਾਈਨ ਸਟੱਡੀ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ ਔਨਲਾਈਨ ਪੜ੍ਹਾਈ ਦਿੰਦੇ ਹਾਂ ਜਿਸ ਨਾਲ ਬੱਚੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੋਰ ਵੀ ਕਾਫੀ ਸਾਰੇ ਅੰਤਰਰਾਸ਼ਟਰੀ ਸਹਿਯੋਗ ਵੀ ਦਿੱਤੇ ਗਏ ਹਨ ਇਸ ਤੋਂ ਵੱਧ ਆਪਾਂ ਦੇਖ ਸਕਦੇ ਹਾਂ ਕਿ ਸਿੱਖਿਆ ਦਾ ਖੇਤਰ ਦੇ ਵਿੱਚ ਸਾਡੀ ਸਰਕਾਰ ਬਹੁਤ ਹੀ ਜ਼ਿਆਦਾ ਵਿਕਾਸ ਕਰਨ ਦੇ ਵਿੱਚ ਲੱਗੀ ਹੋਈ ਹੈ ਜੋ ਕਿ ਉਹਨਾਂ ਲਈ ਤਾਰੀਫ਼ ਲਈ ਬਹੁਤ ਹੀ ਵਧੀਆ ਹੈ ਧੰਨਵਾਦ